ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਟਰੈਵਲ ਏਜੰਸੀ ਤੋਂ ਗੱਲ ਕਰ ਰਹੇ ਹੋ ਜੀ ਮੈਂ ਆਪਣੇ ਘੁੰਮਣ ਲਈ ਇੱਕ ਕੈਬ ਬੁੱਕ ਕੀਤੀ ਸੀ ਜੀ ਜਿਹਦੀ ਡਾਊਨ ਪੇਮੈਂਟ ਮੈਂ ਪਹਿਲਾਂ ਹੀ ਕਰਤੀ ਸੀ ਅਚਾਨਕ ਮੈਨੂੰ ਔਫਿਸ ਦਾ ਅਰਜਟ ਕੰਮ ਨਿਕਲ ਆਇਆ ਅਤੇ ਮੈਨੂੰ ਉੱਧਰ ਜਾਣਾ ਪਏਗਾ ਉਹ ਕੰਮ ਬਹੁਤ ਇੰਪੋਰਟੈਂਟ ਹੈ ਮੇਰੇ ਬਿਨਾਂ ਨਹੀਂ ਹੋ ਸਕਦਾ ਕਿਰਪਾ ਕਰਕੇ ਤੁਸੀਂ ਮੇਰੀ ਜਿਹੜੀ ਪੇਮੈਂਟ ਹੈ ਉਹ ਤੁਸੀਂ ਮੈਨੂੰ ਵਾਪਸ ਕਰ ਸਕਦੇ ਹੋ ਮੈਂ ਤੁਹਾਨੂੰ ਜਿਹੜੀ ਡਾਊਨ ਪੇਮੈਂਟ ਪਹਿਲਾਂ ਕੀਤੀ ਸੀਗੀ ਉਹ ਪਲੀਜ਼ ਕਿਰਪਾ ਕਰਕੇ ਤੁਸੀਂ ਮੈਨੂੰ ਮੇਰੇ ਅਕਾਊਂਟ 'ਚ ਕਦੋਂ ਤੱਕ ਵਾਪਸ ਕਰ ਕਰ ਦੋਗੇ ਥੈਂਕ ਯੂ